ਇਸ ਸਮੇਂ ਪੰਜਾਬ ਵਿੱਚ ਖੇਤੀ ਉਦਯੋਗ ਦੇ ਸਾਹਮਣੇ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਹਨ ਜਿਵੇਂ ਉਨ੍ਹਾਂ ਦੇ ਉਨ੍ਹਾਂ ਨੂੰ ਖੇ ਜੋ ਉਹ ਬੀਜਦੇ ਹਨ ਉਨ੍ਹਾਂ ਦਾ ਸਹੀ ਮੁੱਲ ਨਹੀਂ ਮਿਲਦਾ ਇਸ ਦਾ ਸਭ ਤੋਂ ਬੜਾ ਕਾਰਨ ਹੈ ਕਿ ਉਨ੍ਹਾਂ ਨੂੰ ਦੂਰ ਜਾ ਕੇ ਆਪਣੇ ਜਿਹੜੇ ਖੇਤੀ ਉਦਯੋਗ ਹਨ ਉਹ ਵੇਚਣੇ ਪੈਂਦੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੇੜੇ ਇਨ੍ਹਾਂ ਚੀਜ਼ਾਂ ਨੂੰ ਕਰਨ ਤਾਂ ਕਿ ਜੋ ਕਿਸਾਨ ਹੈ ਉਹ ਨੇੜੇ ਹੀ ਇਨ੍ਹਾਂ ਨੂੰ ਵੇਚ ਸਕਣ ਅਤੇ ਉਨ੍ਹਾਂ ਨੂੰ ਚੰਗਾ ਮੁੱਲ ਮਿਲ ਸਕੇ